ਹੈਲੋ ਹੈਲੋ ਹਾਂਜੀ ਕਾਰਪੇਂਟਰ ਮਨਦੀਪ ਨਾਲ਼ ਗੱਲ ਹੋ ਰਹੀ ਐ ਜੀ ਹਾਂਜੀ ਅਸੀਂ ਨਾ ਬੈਡ ਦੀ ਸਾਈ ਦੇਣੀ ਸੀ ਜੀ ਜੀ ਅਸੀਂ ਬੈੱਡ ਬਣਵੋਣਾ ਗਾ ਹਾਂਜੀ ਢੋਅ ਵਗੈਰਾ ਉਨ ਦੀ ਵੀ ਵਧੀਆ ਹੋਵੇ ਡਰੋਰ ਵਗੈਰਾ ਹੋਣ ਸਾਈਡ ਤੇ ਡਰੋਰ ਰੱਖੇ ਜਾਂਦੇ ਐ ਜਿਹੜੇ ਦੋ ਉਹ ਹੋਣੇ ਚਾਹੀਦੇ ਆ ਤੇ ਹਾਂਜੀ ਤੇ ਲੱਕੜ ਆਪਾਂ ਨੂੰ ਚਾਈਦੀ ਐ ਟਾਹਲੀ ਦੀ ਬੋਕਸ ਬੋਕਸ ਬੈੱਡ ਚਾਈਦੇ ਆ ਗੇ ਤੇ ਜਿਹੜੇ ਪਾਵੇ ਆ ਉਨ ਦੇ ਥੋੜੇ ਉੱਚੇ ਚਾਈਦੇ ਐ ਜਿਹੜਾ ਵੋਕਰ ਵਗੈਰਾ ਮਾਰਨ ਚ ਆਸਾਨੀ ਹੋਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਜ ਕੱਲ੍ਹ ਇੱਕ ਨਵੀਂ ਚੀਜ਼ ਚੱਲੀ ਐ ਬੈੱਡਾਂ ਦੇ ਵਿੱਚ ਜਿਵੇਂ ਹੋਲਡਰ ਵਗੈਰਾ ਚਾਰਜਰ ਵਾਲ਼ੇ ਹੁੰਦੇ ਐ ਨਾ ਉਹ ਢੋਅ ਦੇ ਵਿੱਚ ਈ ਲੈ ਦਿੱਤੇ ਜਾਂਦੇ ਐ ਲਾਈਟਾਂ ਵਗੈਰਾ ਲੱਗੀਆਂ ਹੁੰਦੀਆਂ ਢੋਅ ਦੇ ਵਿੱਚ ਸਾਨੂੰ ਹਮੇ ਓਸੇ ਤਰ੍ਹਾਂ ਦਾ ਬੈੱਡ ਚਾਈਦਾ ਗਾ ਲਾਈਟਿੰਗ ਵਗੈਰਾ ਆਲ਼ਾ ਹਾਂਜੀ ਤੇ ਫਿਰ ਹਾਂਜੀ ਹਾਂਜੀ ਤੇ ਰੇਂਜ ਦੱਸ ਦੋ ਜੀ ਤੁਸੀਂ ਬੈੱਡ ਦੀ ਮਤਲਬ ਕਿੰਨੇ ਪੈਸੇ ਤੱਕ ਬਣਾ ਸਕਦੇ ਓ ਰੇਂਜ 'ਚ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਲੱਕੜ ਨੂੰ ਸਿਓਂਕ ਜ਼ਿਆਦਾ ਲੱਗ ਜਾਂਦੀ ਐ ਲੱਕੜ ਭੁਰਨ ਲੱਗ ਜਾਂਦੀ ਐਗੀ ਉਹਦਾ ਖ਼ਾਸ ਧਿਆਨ ਰੱਖਣਾ ਗਾ ਵੀ ਲੱਕੜ ਨਾ ਭੂਰੇ ਸਿਓਂਕ ਨਾ ਲੱਗੇ ਵੀ ਲੱਕੜ ਵਧੀਆ ਹੀ ਹੋਵੇ

ਹਾਂਜੀ ਹਾਂਜੀ ਉਹ ਤਾਂ ਠੀਕ ਐ ਜੀ ਬਾਕੀ ਆ ਜਿਹੜੇ ਬੋਕਸ ਹੁੰਦੇ ਹੈਗੇ ਨੀਚੇ ਡਰੋਰ ਹੁੰਦੇ ਹੈਗੇ ਵੱਡੇ ਬੈੱਡ ਦੇ ਵਿੱਚ ਉਹ ਸਾਨੂੰ ਵੱਡੇ ਚਾਈਦੇ ਐਗੇ ਜਿਹਦੇ ਵਿੱਚ ਸਮਾਨ ਸਮੂਨ ਰੱਖਣ ਚ ਵੀ ਦਿੱਕਤ ਨਾ ਆਵੇ ਸਾਰਾ ਸਮਾਨ ਵਧੀਆ ਫਿੱਟ ਹੋ ਜੇ ਹਾਂ ਤੇ ਕਈ ਬੈੱਡ ਦੇ ਨੀਚੇ ਡਰੋਰ ਹੁੰਦੇ ਹੈਗੇ ਸਾਈਡ ਵਾਲੇ ਹੋ ਗੇ ਇੱਕ ਨੀਚੇ ਹੁੰਦੇ ਐ ਜੀ ਬੈੱਡ ਦੇ ਨੀਚੇ ਹਾਂਜੀ ਹਾਂਜੀ ਜੁੱਤੇ ਵਗੈਰਾ ਰੱਖਣ ਵਾਲ਼ੇ ਹਾਂਜੀ ਅ ਜੀ ਦੋ ਵਾਲ਼ੇ ਹਾਂਜੀ ਖ਼ਾਸ ਕਰਕੇ ਜਿਹੜੇ ਸਾਇਡਾਂ ਤੇ ਹਾਂਜੀ ਖ਼ਾਸ ਕਰਕੇ ਜਿਹੜੇ ਮਤਲਬ ਉਹ ਢੋਅ ਦੇ ਨਾਲ਼ ਰੱਖੇ ਜਾਂਦੇ ਐ ਨਾ ਬਕਸੇ ਦੋ ਦੋ ਸਾਇਡਾਂ ਵਾਲ਼ੇ ਉਹ ਜ਼ਰੂਰ ਬਨਾਨੇ ਐ ਤੁਸੀਂ ਰੇਂਜ ਦੱਸ ਦੋ ਨਹੀਂ ਤਾਂ ਅਸੀਂ ਓਥੇ ਆ ਆਕੇ ਥੋਨੂੰ ਦੱਸਦਾਂਗੇ ਠੀਕ ਐ ਜੀ ਓਕੇ ਜੀ